ਦੋ ਦਸੰਬਰ ਦੋ ਹਜ਼ਾਰ ਇੱਕ ਪੰਜ ਮਈ ਦੋ ਹਜ਼ਾਰ ਬਾਰਾਂ ਇੱਕ ਜੁਲਾਈ ਦੋ ਹਜ਼ਾਰ ਬਾਈ ਦਸ ਜਨਵਰੀ ਦੋ ਹਜ਼ਾਰ ਦਸ ਇੱਕ ਸਤੰਬਰ ਦੋ ਹਜ਼ਾਰ ਅਠਾਰਾਂ